ਮੈਨੂੰ ਕੂਕਿੰਗ ਕਰਨਾ ਬਹੁਤ ਪਸੰਦ ਹੈ ਅਤੇ ਕੂਕਿੰਗ ਦੇ ਵਿੱਚ ਖ਼ਾਸ ਕਰਕੇ ਮੈਨੂੰ ਬੇਕਿੰਗ ਪਸੰਦ ਹੈ ਕਿਉਂਕਿ ਬੇਕਿੰਗ ਦੇ ਵਿੱਚ ਆਪਾਂ ਘੱਟ ਘਿਓ ਤੇਲ ਦਾ ਇਸਤੇਮਾਲ ਕਰਕੇ ਆਪਾਂ ਇੱਕ ਹੈਲਦੀ ਚੀਜ਼ ਬਣਾ ਸਕਦੇ ਹਾਂ ਅਤੇ ਅੱਜ ਕੱਲ੍ਹ ਮੈਂ ਮੈਨੂੰ ਕੇਕ ਬਣਾਉਣਾ ਸੌਖਾ ਲੱਗਦਾ ਹੈ ਕਿਉਂਕਿ ਉਸ ਦੇ ਵਿੱਚ ਆਪਾਂ ਕੁਛ ਵੀ ਲੰਬਾ ਚੋੜਾ ਕੋਈ ਪ੍ਰੋਸੈਸ ਨਹੀਂ ਹੁੰਦਾ ਨੰ ਨਾ ਹੀ ਜਿਹੜਾ ਇੱਕ ਹੈਲਦੀ ਕੇਕ ਹੈ ਉਹ ਆਪਾਂ ਘਰ ਦੇ ਸਮਾਨ ਤੋਂ ਹੀ ਬਣਾ ਸਕਦੇ ਹਾਂ ਅਤੇ ਇਸ ਵਿੱਚ ਇੱਕ ਇਹ ਵੀ ਇੱਕ ਕੁੱਕਰ ਓ ਟੀ ਜੀ ਨਾ ਵੀ ਹੋਵੇ ਤਾਂ ਆਪਾਂ ਕਿਸੇ ਕੁੱਕਰ ਜਾਂ ਕੜਾਹੀ ਦੇ ਵਿੱਚ ਵੀ ਕੇਕ ਨੂੰ ਬੇਕ ਕਰ ਸਕਦੇ ਹਾਂ ਅਤੇ ਉਸ ਦੇ ਨਾਲ ਨਾਲ ਆਪਾਂ ਕੂਕੀਜ ਬਿਸਕੁਟ ਵੀ ਆਸਾਨੀ ਨਾਲ ਬਿਨਾਂ ਘਿਓ ਤੇਲ ਘੱਟ ਯੂਜ ਕਰਕੇ ਆਪਾਂ ਘਰ ਦੇ ਸਮਾਨ ਤੋਂ ਹੀ ਤਿਆਰ ਕਰ ਸਕਦੇ ਹਨ ਜੋ ਕਿ ਮੈਨੂੰ ਬਣਾਉਣਾ ਬੜਾ ਸੌਖਾ ਲੱਗਦਾ ਹੈ ਅਤੇ ਮੈਂ ਉਸਨੂੰ ਪਸੰਦ ਵੀ ਕਰਦੀ ਹੈ ਖਾਣਾ ਵੀ ਪਸੰਦ ਕਰਦੀ ਹਾਂ